ਦੋ ਜਨਵਰੀ ਦੋ ਹਜ਼ਾਰ ਪੰਦਰਾਂ ਚੌਵੀ ਦਸੰਬਰ ਦੋ ਹਜ਼ਾਰ ਬਾਰਾਂ ਦਸ ਨਵੰਬਰ ਉੱਨੀ ਸੌ ਉਣਾਨਵੇਂ ਚੌਵੀ ਜੁਲਾਈ ਦੋ ਹਜ਼ਾਰ ਇੱਕੀ ਤਿੰਨ ਮਈ ਦੋ ਹਜ਼ਾਰ